ਮੇਰੀ ਆਪਣੀ ਜ਼ਿੰਦਗੀ ਦਾ ਯਾਦਗਾਰ ਅਨੁਭਵ ਇਹ ਹੈ ਕਿ ਮੈਂ ਆਪਣੇ ਕਮਰੇ ਦੀ ਦੀਵਾਰ 'ਤੇ ਅਲੱਗ ਅਲੱਗ ਤਰ੍ਹਾਂ ਦੇ ਦ੍ਰਿਸ਼ ਦਰਸਾਏ ਹੋਏ ਹਨ ਜੋ ਕਿ ਮੇਰੇ ਲਈ ਬਹੁਤ ਖ਼ਾਸ ਹੈ ਇਹ ਮੈਨੂੰ ਉੱਠਦੇ ਬਹਿੰਦੇ ਸੌਂਦੇ ਜਾਗਦੇ ਬਹੁਤ ਚੰਗਾ ਸ਼ਾਂਤ ਅਤੇ ਵਧੀਆ ਮਾਹੌਲ ਪ੍ਰਦਾਨ ਕਰਨ ਵਾਲੀ ਸਿਚੁਏਸ਼ਨ ਦਿੰਦੇ ਹਨ ਮੈਂ ਬਹੁਤ ਚੰਗਾ ਮਹਿਸੂਸ ਕਰਦੀ ਹਾਂ ਜਦੋਂ ਘਰ ਵਿੱਚ ਕੋਈ ਵੀ ਰਿਸ਼ਤੇਦਾਰ ਜਾਂ ਗੁਆਂਡੀ ਆ ਕੇ ਮੇਰੇ ਕਮਰੇ ਦੀ ਦੀਵਾਰ 'ਤੇ ਕੀਤੀ ਚਿੱਤਰ ਦੀ ਪ੍ਰਸ਼ੰਸਾ ਕਰਦੇ ਹਨ ਅਤੇ ਮੈਨੂੰ ਪਰਾਊਡ ਫੀਲ ਕਰਵਾਉਂਦੇ ਹਨ ਜਿਸ ਨਾਲ ਮੈਨੂੰ ਹੋਰ ਚੰਗੀ ਪ੍ਰੇਰਨਾ ਮਿਲਦੀ ਹੈ ਅਤੇ ਮੇਰੇ ਅੰਦਰ ਹੌਂਸਲਾ ਪੈਦਾ ਹੁੰਦਾ ਹੈ